ਸਤਿ ਸ਼੍ਰੀ ਅਕਾਲ ਸਰ ਮੈਂ ਦਲਜੀਤ ਕੌਰ ਜਿਸ ਨੇ ਕੱਲ੍ਹ ਰਾਤ ਇੱਕ ਰਾਈਡ ਬੁੱਕ ਕੀਤੀ ਸੀਗੀ ਪਟਿਆਲਾ ਤੋਂ ਚੰਡੀਗੜ੍ਹ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਮੇਰਾ ਪਿੱਕਅਪ ਸ਼ਟੇਸ਼ਨ ਹੋਏਗਾ ਪਟਿਆਲਾ ਮੇਰਾ ਹੌਮ ਐਂਡ ਜੋ ਡਰੋਪਆਊਟ ਸਟੇਸ਼ਨ ਸੀਗਾ ਉਹ ਸੀਗਾ ਖਾਲਸਾ ਕੋਲੇਜ ਚੰਡੀਗੜ੍ਹ ਅਸਲ 'ਚ ਮੇਰੀ ਇੰਟਰਵਿਊ ਸੀਗੀ ਕੱਲ੍ਹ ਨੋ ਵਜੇ ਪਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਇੱਥੋਂ ਸੱਤ ਵਜੇ ਚੱਲਾਂਗੇ ਪਰ ਤੁਸੀਂ ਕਾਫੀ ਲੇਟ ਕਰਤਾ ਜਿਸ ਤੋਂ ਬਾਅਦ ਮੈਂ ਤੁਹਾਨੂੰ ਕਾਫੀ ਕੋਲਸ ਵੀ ਕੀਤੀਆਂ ਸੀਗੀਆਂ ਕਿ ਮੈਂ ਲੇਟ ਹੋ ਰਹੀ ਹਾਂ ਓਰ ਮੇਰਾ ਇੰਟਰਵਿਊ ਨਿਕਲ ਰਿਹਾ ਸੀ ਪਰ ਤੂਸੀਂ ਨਹੀਂ ਆਏ ਸੋ ਹੁਣ ਮੈਂ ਇਹ ਦੱਸਣਾ ਸੀਗਾ ਕਿ ਮੈਂ ਆਪਣੇ ਪਾਪਾ ਦੇ ਨਾਲ ਹੀ ਜਾ ਰਹੀ ਹਾਂ ਅਤੇ ਤੁਸੀਂ ਹੁਣ ਇਹ ਵਾਲੀ ਰਾਈਡ ਕੀ ਹੈ ਕੈਂਸਲ ਕਰ ਦਿਉ ਕਿਉਂਕਿ ਮੈਂ ਓਲਰੇਡੀ ਆਪਣੇ ਸਟੇਸ਼ਨ ਛੱਡ ਚੁੱਕੀ ਹਾਂ ਓਰ ਮੈਂ ਮਿਡ ਰਸਤੇ ਹਾਂ ਸੋ ਜਿਸ ਕਰਕੇ ਮੈਂ ਸੋਰੀ ਵੀ ਫੀਲ ਕਰਦੀ ਹਾਂ ਬਟ ਤੁਸੀਂ ਆਏ ਨਹੀਂ ਸੋ ਥੋੜ੍ਹੀ ਗਲਤੀ ਤੁਹਾਡੀ ਵੀ ਹੈ ਅਤੇ ਥੋੜ੍ਹੀ ਮੇਰੀ ਵੀ ਹੈ ਕਿਉਂਕਿ ਮੈਨੂੰ ਵੀ ਜਲਦੀ ਸੀ ਬਟ ਤੁਸੀਂ ਵੀ ਨਹੀਂ ਆਏ ਸੋ ਪਲੀਜ਼ ਤੁਸੀਂ ਮੇਰੀ ਹੁਣ ਰਾਇਡ ਹੈ ਜੋ ਕੈਂਸਲ ਕਰ ਦਿੱਤੀ ਜਾਵੇ ਥੈਂਕ ਯੂ